ਭੰਗੜੇ ਦੇ ਆਮ ਸਟੈਪ ਝੂਮਰ ਧਮਾਲ ਲੁੱਡੀ ਸੰਮੀ ਸਿੰਗਲ ਜਾਫਾ ਡਬਲ ਜਾਫਾ ਇਹ ਭੰਗੜੇ ਦੇ ਕੁਝ ਮਹੱਤਵਪੂਰਨ ਸਟੈਪ ਹਨ ਉਂਝ ਤਾਂ ਭੰਗੜਾ ਉਹ ਹੱਥਾਂ ਨਾਲ ਪੈਰਾਂ ਨਾਲ ਬਾਹਵਾਂ ਨਾਲ ਪਾਇਆ ਜਾ ਸਕਦਾ ਹੈ ਉਹ ਪੰਜਾਬੀ ਸੱਭਿਆਚਾਰ ਸੁਭਾਅ ਵਿੱਚ ਕਾਫੀ ਯੋਗਦਾਨ ਹੈ ਭੰਗੜਾ ਸਾਡੇ ਵਿੱਚ ਉਤਸ਼ਾਹ ਖੁਸ਼ੀ ਪ੍ਰਸੰਨਤਾ ਆਨੰਦ ਪ੍ਰਗਟ ਕਰਦਾ ਹੈ ਭੰਗੜਾ ਸਾਡੀ ਆਨ ਬਾਨ ਸ਼ਾਨ ਹੈ ਪੰਜਾਬੀ ਭੰਗੜਾ ਬਹੁਤ ਪ੍ਰਚਲਿਤ ਹੈ ਪੰਜਾਬ ਦੇ ਹਰ ਮੌਕਿਆਂ ਅਵਸਰਾਂ ਪ੍ਰੋਗਰਾਮਾਂ 'ਤੇ ਪਾਇਆ ਜਾਂਦਾ ਹੈ ਭੰਗੜੇ ਦਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕਾਫੀ ਮਹੱਤਵ ਹੈ